ਚਾਰ ਮਾਰਚ ਵੀਹ ਵੀਹ ਅਠਾਰ੍ਹਾਂ ਜਨਵਰੀ ਉੱਨੀ ਪਝੱਤਰ ਸੌਲ੍ਹਾਂ ਮਈ ਸਤਾਰ੍ਹਾਂ ਵੀਹ ਅਠਾਰ੍ਹਾਂ ਅਪ੍ਰੈਲ ਵੀਹ ਇੱਕੀ ਚੌਦ੍ਹਾਂ ਫਰਵਰੀ ਅਠਾਰ੍ਹਾਂ ਚਾਲ੍ਹੀ